ਸਾਡੇ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਸੈਲਾਨੀਆਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਸਾਡੇ ਇੱਥੇ ਛੋਟੀਆਂ ਸੜਕਾਂ ਹੋਣ ਕਰਕੇ ਘੱਟ ਰਸਤਿਆਂ ਦਾ ਪਤਾ ਹੋਣਾ ਸਭ ਤੋਂ ਮੇਨ ਸਮੱਸਿਆ ਖੇਤਰੀ ਭਾਸ਼ਾਵਾਂ ਦਾ ਗਿਆਨ ਨਾ ਹੋਣਾ ਜੋ ਕਿ ਇੱਥੋਂ ਦੇ ਟੈਕਸੀ ਚਾਲਕ ਜਾਂ ਆਟੋ ਚਾਲਕ ਰਿਕਸ਼ਾ ਚਾਲਕ ਜਿਹੜੇ ਨੇ ਉਹਨਾਂ ਦਾ ਜ਼ਿਆਦਾ ਐਜੂਕੇਟਿਡ ਨਾ ਹੋਣਾ ਜਿਵੇਂ ਕਿ ਖੇਤਰੀ ਭਾਸ਼ਾਵਾਂ ਦੇ ਲੋਕ ਜਿਹੜੇ ਹਿੰਦੁਸਤਾਨ ਦੇ ਅਲੱਗ ਅਲੱਗ ਇਲਾਕਿਆਂ ਤੋਂ ਅੰਮ੍ਰਿਤਸਰ ਦੇ ਵਿੱਚ ਇੱਥੇ ਘੁੰਮਣ ਫਿਰਨ ਦਰਸ਼ਨ ਕਰਨ ਹਰਿਮੰਦਰ ਸਾਹਿਬ ਦੇ ਦੁਰਗਿਆਣਾ ਮੰਦਰ ਦੇ ਔਰ ਵਾਹਗਾ ਬੋਰਡਰ ਦੇ ਜਾਂ ਹੋਰ ਧਾਰਮਿਕ ਸਥਾਨਾਂ ਦੇ ਇੱਥੇ ਘੁੰਮਣ ਲਈ ਆਉਂਦੇ ਹਨ ਉਹਨਾਂ ਨੂੰ ਆਉਣ ਕੇ ਇੱਥੋਂ ਦੀਆਂ ਸੜਕਾਂ ਦਾ ਗਿਆਨ ਨਾ ਹੋਣਾ ਔਰ ਇੱਥੇ ਦੀ ਭਾਸ਼ਾ ਦਾ ਕਿਉਂਕਿ ਇੱਥੇ ਪੰਜਾਬ ਵਿੱਚ ਜ਼ਿਆਦਾ ਭਾਸ਼ਾ ਪੰਜਾਬੀ ਹੀ ਬੋਲੀ ਜਾਂਦੀ ਹੈ ਔਰ ਪੰਜਾਬੀ ਡਰਾਈਵਰ ਜੋ ਨੇ ਉਹਨਾਂ ਨੂੰ ਖੇਤਰੀ ਭਾਸ਼ਾਵਾਂ ਦਾ ਗਿਆਨ ਘੱਟ ਹੈ ਜਿਹਦੇ ਕਰਕੇ ਇੱਥੇ ਸੈਲਾਨੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਆਉਣ ਜਾਣ ਲਈ ਜਾਂ ਰਹਿਣ ਵਾਸਤੇ ਰੈਸਟੋਰੈਂਟਾਂ ਲਈ ਹੋਟਲਾਂ ਦੇ ਵਿੱਚ ਆਉਣ ਜਾਣ ਦੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਖਾਣਿਆਂ ਦਾ ਵੀ ਇੱਥੇ ਜ਼ਿਆਦਾ ਪੰਜਾਬੀ ਖਾਣਾ ਹੀ ਆ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਹੋਟਲਾਂ 'ਤੇ ਮਿਲਦਾ ਹੈ ਜਾਂ ਫੂਡ ਕੋਰਟਾਂ ਦੇ ਵਿੱਚ ਰੇਹੜੀ ਮਾਰਕੀਟਾਂ 'ਤੇ ਇਹੋ ਖਾਣਾ ਹੀ ਜ਼ਿਆਦਾ ਮਿਲਦਾ ਹੈ ਜਾਂ ਅੱਜ ਕੱਲ੍ਹ ਚਾਈਨੀਜ਼ ਖਾਣਾ ਮਿਲ ਜਾਂਦਾ ਹੈ ਜਿਹੜਾ ਕਿ ਬਹੁਤ ਸਾਰੇ ਜੇ ਜਿਹੜੇ ਕਿ ਪਿੰਡਾਂ ਤੋਂ ਆਏ ਹੋਏ ਜਾਂ ਹੋਰ ਪਛੜੇ ਇਲਾਕਿਆਂ ਤੋਂ ਸੈਲਾਨੀ ਇੱਥੇ ਆਉਂਦੇ ਹਨ ਉਹਨਾਂ ਨੂੰ ਖਾਣ 'ਚ ਦਿੱਕਤ ਆਉਂਦੀ ਹੈ ਔਰ ਇੱਥੇ ਘੁੰਮਣ ਫਿਰਨ ਵਾਸਤੇ ਵੀ ਬਹੁਤ ਜ਼ਿਆਦਾ ਥਾਵਾਂ ਨਹੀਂ ਹਨ ਜਾਂ ਇਹਨਾਂ ਦਾ ਸੈਲਾਨੀਆਂ ਨੂੰ ਘੱਟ ਗਿਆਨ ਹੁੰਦਾ ਹੈ ਜਿਸ ਤਰ੍ਹਾਂ ਕਿ ਫੋਰਨ ਤੋਂ ਵੀ ਇੱਥੇ ਫੋਰਨਰਸ ਬਹੁਤ ਅਲੱਗ ਅਲੱਗ ਮੁਲਖਾਂ ਤੋਂ ਆਉਂਦੇ ਹਨ ਉਹਨਾਂ ਨੂੰ ਵੀ ਇੱਥੇ ਆ ਕੇ ਬਹੁਤ ਪਰੇਸ਼ਾਨੀ ਕਮਿਊਨੀਕੇਸ਼ਨ ਦੀ ਆਉਂਦੀ ਹੈ ਅਤੇ ਇੱਥੇ ਜ਼ਿਆਦਾ ਲੋਕ ਜਿਹੜੇ ਨੇ ਇਹਨਾਂ ਨਾਲ ਦੁਰਵਿਵਹਾਰ ਵੱਧ ਕਰਾਇਆ ਔਰ ਮਿਸਗਾਈਡੈਂਸ ਜ਼ਿਆਦਾ ਕਰਦੇ ਹਨ ਸਰਕਾਰ ਵੱਲੋਂ ਵੀ ਇੱਥੇ ਕੋਈ ਜ਼ਿਆਦਾ ਸਾਈਨ ਬੋਰਡ ਇੰਗਲਿਸ਼ ਪੰਜਾਬੀ ਦੇ ਵਿੱਚ ਨਾ ਹੋਣ ਕਰਕੇ ਜਾਂ ਹੋਰ ਖੇਤਰੀ ਭਾਸ਼ਾਵਾਂ ਦੇ ਵਿੱਚ ਨਾ ਹੋਣ ਕਰਕੇ ਦਿੱਕਤ ਆਉਂਦੀ ਹੈ ਰਸਤਿਆਂ ਦੀ ਆਉਣ ਜਾਣ ਦੀ ਬਜ਼ਾਰਾਂ ਦੀ ਹੋਰ ਕਾਫ਼ੀ ਸਾਰੀਆਂ ਸਮੱਸਿਆਂ ਸੈਲਾਨੀਆਂ ਨੂੰ ਸਾਡੇ ਸ਼ਹਿਰ 'ਚ ਆਉਂਦੀਆਂ ਹਨ ਮੌਜੂਦਾ ਹਾਲਤ ਵਿੱਚ